ਹਾਂਜੀ ਸਰ ਮਿਊਜਿਕ ਟੀਚਰ ਬੋਲਦੇ ਪਏ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਮੈਂ ਕੁਝ ਮਿਊਜਿਕ ਪਰਸਨੈਲਿਟੀਜ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਦੱਸ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਇਹਨਾਂ ਦੇ ਬਾਰੇ ਜਾਣਕਾਰੀ ਇਹ ਹੀ ਲੈਣੀ ਸੀ ਕਿ ਆਪਾਂ ਇਹਨਾਂ ਦੇ ਫੰਕਸ਼ਨ ਦੇ ਵਿੱਚ ਇਹਨਾਂ ਨੂੰ ਬੁਲਾਉਣਾ ਸੀ ਕਿਸੇ ਦਾ ਮਤਲਬ ਕਿ ਜਿਵੇਂ ਦਲਜੀਤ ਦੋਸਾਂਝ ਆ ਉਹਨਾਂ ਦਾ ਕਿੰਨਾ ਕੁ ਖਰਚਾ ਆ ਸਕਦਾ ਹਾਂਜੀ ਅੱਛ ਠੀਕ ਓਕੇ ਕਲਾਕਾਰ ਚਲੋ ਬਾਅਦ ਵਿੱਚ ਦੱਸਦੇ ਹਾਂ ਆਪਾਂ ਅਤੇ ਜੇ ਆਪਣੇ ਬੱਚੇ ਨੂੰ ਆਪਾਂ ਮਤਲਬ ਕਿ ਕਿਸੇ ਮਿਊਜਿਕ ਪਰਸਨੈਲਿਟੀ ਬਾਰੇ ਦੱਸਣਾ ਹੈ ਜਾਂ ਸਿਖਾਉਣਾ ਹੈ ਅਤੇ ਉਹਨਾਂ ਦੀ ਅਕੈਡਮੀ ਕੋਈ ਦੱਸ ਸਕਦੇ ਜੇ ਹਾਂਜੀ ਅੱਛਾ ਠੀਕ ਹੈ ਹਾਂਜੀ ਸਰ ਸੰਤੁਸ਼ਟ ਹਾਂ ਪਰ ਕੰਨਫਰਮ ਕਰਕੇ ਦੱਸਣਾ ਪਲੀਜ਼ ਓਕੇ ਸਰ ਓਕੇ